ਹੈਲੋ ਰਾਮ ਰਾਮ ਸਰ ਜੀ ਜੀ ਸਰ ਠੀਕ ਠੀਕ ਸਰ ਠੀਕ ਹੈ ਸਰ ਕਿੱਥੋਂ ਆਏਂ ਤੁਸੀਂ ਸਰ ਠੀਕ ਹੈ ਠੀਕ ਹੈ ਸਰ ਇੱਥੇ ਸਰ ਕਾਫ਼ੀ ਚੀਜ਼ਾਂ ਹੈਗੀਆਂ ਕਈ ਧਾਰਮਿਕ ਸਥਾਨ ਵੀ ਹੈਗੇ ਆ ਇੱਥੇ ਜਿਹੜੇ ਘੁੰਮਣ ਵਾਲੇ ਆ ਡੇਲੀ ਦੇ ਟੂਰਿਸਟ ਆਉਂਦੇ ਆ ਉੱਥੇ ਬਾਕੀ ਜੇ ਪਾਰਕ ਪੂਰਕ ਹੋਣਾ ਤਾਂ ਪਾਰਕ ਇੱਥੇ ਗੁਰਦਾਸਪੁਰ ਦੇ ਵਿੱਚ ਹੋਣੇ ਆ ਅਤੇ ਗੁਰਦਾਸਪੁਰ ਦੇ ਵਿੱਚ ਇੱਕ ਫਿਸ਼ ਪਾਰਕ ਆ ਬੜਾ ਫੇਮਸ ਪਾਰਕ ਆ ਗੁਰਦਾਸਪੁਰ ਦਾ ਉੱਥੇ ਕਾਫ਼ੀ ਜਿੱਦਾਂ ਤੁਹਾਡੇ ਨਾਲ ਬੱਚੇ ਵੀ ਹੋਣੇ ਫੈਮਲੀ ਹੋਣੀ ਨਾਲ ਪੂਰੀ ਹਾਂਜੀ ਉੱਥੇ ਕਾਫ਼ੀ ਚੀਜ਼ਾਂ ਜਿੱਦਾਂ ਫਾਸਟ ਫੂਡ ਵਗੈਰਾ ਸਟਰੀਟ ਫੂਡ ਪਸੰਦ ਕਰਦੇ ਲੋਕੀ ਉਹ ਵੀ ਖਾਣ ਨੂੰ ਹੈਗਾ ਬਾਕੀ ਝੂਲੇ ਝਾਲੇ ਲੱਗੇ ਹੋਏ ਆ ਕਾਫ਼ੀ ਖੇਡਣ ਵਾਲੀਆਂ ਚੀਜ਼ਾਂ ਵੀ ਹੈਗੀਆਂ ਐਕਟੀਵਿਟੀ ਵਾਸਤੇ ਫਿਜ਼ੀਕਲ ਐਕਟੀਵਿਟੀ ਵਾਸਤੇ ਸਰ ਤੁਸੀਂ ਹਨੂਮਾਨ ਚੌਂਕ ਹੈ ਜੀ ਉੱਥੇ ਆ ਜਾਇਓ ਮੈਂ ਤੁਹਾਨੂੰ ਉੱਥੋਂ ਪਿੱਕ ਕਰ ਲਵਾਂਗਾ ਅਤੇ ਨਹੀਂ ਤਾਂ ਬਗਵਾਨ ਸ਼੍ਰੀ ਪਰਸ਼ੂਰਾਮ ਚੌਂਕ ਵੀ ਹੈਗਾ

ਠੀਕ ਹੈ ਜੀ ਉੱਥੇ ਤੁਸੀਂ ਕਰ ਦਿਓ ਹੋਰ ਵੀ ਦੋ ਤਿੰਨ ਜਗ੍ਹਾ ਹੈਗਾ ਇੱਥੇ ਪੰਡੋਰੀ ਦਾਮ ਹੈ ਬਹੁਤ ਵਧੀਆ ਫੇਮਸ ਉੱਥੇ ਕਾਫ਼ੀ ਪ੍ਰਾਚੀਨ ਹਾਂਜੀ ਹਾਂਜੀ ਪ੍ਰਾਚੀਨ ਮੰਦਰ ਹੈ ਕਾਫ਼ੀ ਪੁਰਾਣਾ ਅਤੇ ਉਹ ਵੀ ਬਹੁਤ ਵਧੀਆ ਜਗ੍ਹਾ ਹੈ ਉਹ ਵੀ ਤੁਹਾਨੂੰ ਘੁੰਮਾਵਾਂਗੇ ਹੋਰ ਵੀ ਕਾਫ਼ੀ ਚੀਜ਼ਾਂ ਹੈਗੀਆਂ ਇੱਥੇ ਦੇਖਣ ਵਾਲੀਆਂ ਠੀਕ ਹੈ ਸਰ ਬਿਲਕੁਲ ਜੀ ਹਾਂਜੀ